ਵਿਆਹਾਂ ਵਰਗੇ ਵੱਡੇ ਮਾ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਮੈਂ ਸਭ ਤੋਂ ਪਹਿਲਾਂ ਰੈਡੀਮੇਡ ਵੋਟਰ ਦਾ ਪ੍ਰਬੰਧ ਕਰੂੰਗੀ ਜੋ ਕਿ ਕੱਪਾਂ ਵਿੱਚ ਆਉਂਦਾ ਹੈ ਅਤੇ ਸਸਤਾ ਵੀ ਪੈਂਦਾ ਹੈ ਅਤੇ ਜੇ ਉਹਦੇ ਨਾਲ਼ ਵੀ ਨਾ ਪੂਰਾ ਹੋਇਆ ਤਾਂ ਫਿਰ ਇੱਕ ਬੋਟਲਾਂ ਵੀ ਆਉਂਦੀਆਂ ਹਨ ਛੋਟੀਆਂ ਛੋਟੀਆਂ ਜੋ ਕਿ ਵੀ ਵਧੀਆ ਹੁੰਦੀਆਂ ਹਨ ਜਿਹਦੇ ਨਾਲ਼ ਲੋਕ ਵਧੀਆ ਤਰੀਕੇ ਨਾਲ਼ ਉਹ ਪਾਣੀ ਇੱਕ ਬੋਟਲ ਨਾਲ਼ ਹੀ ਆਪਣੀ ਪਿਆਸ ਬੁਝਾ ਸਕਦੇ ਹਨ ਕਈ ਵਾਰੀ ਕੀ ਹੁੰਦਾ ਹੈ ਕਿ ਕੱਪ ਵੀ ਨਹੀਂ ਮਿਲਦੇ ਅਤੇ ਬੋਤਲਾਂ ਵੀ ਨਹੀਂ ਮਿਲਦੀਆਂ ਤਾਂ ਫਿਰ ਮੈਂ ਇਹ ਕਰ ਸਕਦੀ ਹਾਂ ਕਿ ਵੀਹ ਲੀਟਰ ਵਾਲੇ ਟੈਂਕਰ ਹੁੰਦੇ ਹਨ ਉਹ ਮੰਗਵਾ ਸਕਦੀ ਹਾਂ ਅਤੇ ਉਹਦੇ ਨਾਲ਼ ਪਾਣੀ ਨੂੰ ਇੱਧਰ ਉੱਧਰ ਭੇਜ ਸਕਦੀ ਹਾਂ ਅਤੇ ਉਹਦੇ ਨਾਲ਼ ਕੀ ਹੋਏਗਾ ਕਿ ਇੱਕ ਤਾਂ ਵੇਸਟੇਜ ਵੀ ਘੱਟ ਹੋਏਗੀ ਕਿ ਲੋਕ ਇੱਕ ਕੱਪ ਹੀ ਲੈਣਗੇ ਜਾਂ ਫਿਰ ਆਪਣੀ ਮਰਜ਼ੀ ਨਾਲ਼ ਹੀ ਪਾਣੀ ਪੀਣਗੇ ਜਾਂ ਲੈਣਗੇ ਕਈ ਵਾਰੀ ਕੀ ਹੁੰਦਾ ਹੈ ਕਿ ਉਹ ਟੈਂਕਰ ਔਡਰ 'ਤੇ ਮੰਗਵਾਉਣੇ ਪੈਂਦੇ ਹਨ ਅਤੇ ਜੇ ਉਹ ਔਡਰ ਲੇਟ ਦਿੱਤਾ ਜਾਵੇ ਤਾਂ ਵੀ ਉਹ ਔਡਰ ਕੈਂਸਲ ਹੋ ਜਾਂਦਾ ਹੈ ਅਤੇ ਉਹਦੇ ਲਈ ਫਿਰ ਮੈਂ ਡ੍ਰੰਮ ਦਾ ਇੰਤਜ਼ਾਮ ਕਰੂੰਗੀ ਜੋ ਕਿ ਜਿਹਦੇ ਨਾਲ਼ ਪਾਣੀ ਟੈਂਕੀ ਤੋਂ ਥੱਲੇ ਆਏਗਾ ਅਤੇ ਕੱਪਾਂ ਵਿੱਚ ਭਰ ਭਰ ਕੇ ਦਿੱਤਾ ਜਾਵੇਗਾ ਅਤੇ ਇਹਦੇ ਨਾਲ਼ ਇਹ ਵੀ ਹੋ ਸਕਦਾ ਹੈ ਕਿ ਲੋਕ ਉਸ ਪਾਣੀ ਨੂੰ ਜ਼ਿਆਦਾ ਨੀਚੇ ਨਾ ਸੁੱਟਣ ਕਿਉਂਕਿ ਅਸੀਂ ਦੇਖਦੇ ਹਾਂ ਕਿ ਵਿਆਹਾਂ ਸ਼ਾਦੀਆਂ ਵਿੱਚ ਪਾਣੀ ਦੀ ਬੜੀ ਬੇਅਦਬੀ ਹੁੰਦੀ ਹੈ ਕਿਉਂਕਿ ਬੱਚੇ ਕੱਪ ਖੋਲ੍ਹ ਖੋਲ੍ਹ ਕੇ ਉਹਨੂੰ ਸੁੱਟ ਦਿੰਦੇ ਹਨ ਬੋਤਲਾਂ ਖੋਲ੍ਹ ਖੋਲ੍ਹ ਕੇ ਸੁੱਟ ਦਿੰਦੇ ਹਨ ਕਿਉਂਕਿ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਪਾਣੀ ਦੀ ਵਰਤੋਂ ਸੰਭਾਲ ਨਾਲ਼ ਕਰਨੀ ਚਾਹੀਦੀ ਹੈ